ਹੈਲੋ ਹਾਂਜੀ ਬਸ ਵਧੀਆ ਵਧੀਆ ਤੁਸੀਂ ਸੁਣਾਓ ਕਿਵੇਂ ਹੋ ਹਾਂਜੀ ਹਾਂ ਦੀਦੀ ਦੱਸੋ ਹਾਂ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਜੇਕਰ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤੁਸੀਂ ਪੁੱਛ ਲਓ ਮੈਂ ਚੱਲ ਵੜਾਂਗੀ ਨਾਲ ਨਹੀਂ ਤਾਂ ਇੱਥੇ ਵੀ ਜਿਵੇਂ ਤੁਸੀਂ ਲੈਣਾ ਕੀ ਹੈਗਾ ਪਹਿਲਾਂ ਮੈਨੂੰ ਆਂਏਂ ਦੱਸੋ ਵੀ ਕਿਵੇਂ ਹੁਣ ਕੋਈ ਕਿਸ ਚੀਜ਼ ਦੀ ਲੋੜ ਹੈ ਤੁਹਾਨੂੰ ਹੁਣ ਨਹੀਂ ਤਾਜ਼ਾ ਫਰੂਟ ਹਾਂ ਜੇ ਤਾਂ ਤੁਸੀਂ ਤਾਜ਼ਾ ਫਰੂਟ ਹੀ ਲੈਣਾ ਤਾਂ ਆਪਣੇ ਇੱਥੇ ਰੇਹੜੀਆਂ ਵੀ ਆਉਂਦੀਆਂ ਵੀ ਆਪਣੇ ਗਲੀ 'ਚ ਹੀ ਆਉਂਦੀਆਂ ਉਹਨਾਂ ਕੋਲ ਵੀ ਤਾਜ਼ਾ ਹੁੰਦਾ ਪਰ ਆਂਏਂ ਆ ਵੀ ਜਿਵੇਂ ਉਹਨਾਂ ਕੋਲ ਹੁੰਦਾ ਤਾਂ ਤਾਜ਼ਾ ਅਤੇ ਪਰ ਉਹ ਥੋੜ੍ਹਾ ਮਹਿੰਗਾ ਲਾਉਂਦੇ ਆ ਜਿਵੇਂ ਹੁਣ ਜੇ ਟਾਈਮ ਕੱਢ ਕੇ ਜਿਵੇਂ ਕਈ ਵਾਰੀ ਸੁਬਹਾ ਸੁਬਹਾ ਜਾ ਸਕਦੇ ਆਪਾਂ ਮੰਡੀਆਂ ਵੀ ਲੱਗਦੀਆਂ ਇੱਥੇ ਜਿਵੇਂ ਹਾਂ ਮੰਡੀਆਂ ਦੇ ਵਿੱਚੋਂ ਸਸਤਾ ਲੈ ਸਕਦੇ ਹੋ ਹੈਗੇ ਹਾਂ ਵੀ ਰੇਟ ਵੀ ਠੀਕ ਹੁੰਦਾ ਸਸਤਾ ਤਾਂ ਕੀ ਵੀ ਚੀਜ਼ ਤਾ ਤਾਜ਼ੀ ਮਿਲ ਜਾਂਦੀ ਵਧੀਆ ਮਿਲ ਜਾਂਦੀ ਹੈ ਦੋ ਮੰਡੀਆਂ ਹੈਗੀਆਂ ਆਪਣੇ ਇੱਥੇ ਹਾਂ ਅਤੇ ਵੈਸੇ ਤਾਂ ਕੀ ਨਾਮ ਹੈਗਾ ਜ਼ਿਆਦਾਤਰ ਤਾਂ ਜਿਵੇਂ ਗਲੀ ਦੇ ਵਿੱਚ ਆ ਜਾਂਦੀ ਆ ਉਹੀ ਲੈ ਲੈਂਦੇ ਹਾਂ ਵੀ ਜਿਵੇਂ ਜਿ ਜ਼ਿਆਦਾ ਟਾਈਮ ਹੈਗਾ ਫੇਰ ਤਾਂ ਮੰਡੀ ਚਲੇ ਜਾਂਦੇ ਹਾਂ ਨਹੀਂ ਤਾਂ ਫਿਰ ਆਪਣੇ ਹੁਣ ਉਹੀ ਗੱਲ ਕਈ ਵਾਰੀ ਟਾਈਮ ਵੀ ਨਹੀਂ ਨਿਕਲਦਾ ਹੈ ਨਾ ਅਤੇ ਗਲੀ 'ਚ ਆਉਂਦਾ ਫਰੂਟ ਵੀ ਦਿੰਦੇ ਵਧੀਆ ਅਤੇ ਸਬਜ਼ੀ ਵੀ ਵਧੀਆ ਲੈ ਕੇ ਆਉਂਦੇ ਹੈ ਹਾਂ ਹਾਂ ਇੱਥੋਂ ਵੀ ਲੈ ਲੈਂਦੇ ਕਈ ਵਾਰੀ ਮੰਡੀ 'ਚੋਂ ਵੀ ਲੈ ਲੈਂਦੇ ਹਾਂ ਜਿਵੇਂ ਜੇ ਕੋਈ ਵੀ ਕੁਦਰਤੀ ਮੰਡੀ ਜਾਣਾ ਹੋਇਆ ਫਿਰ ਦੇਖ ਲਵਾਂਗੇ ਮੈਂ ਤੁਹਾਨੂੰ ਕਾਲ ਕਰ ਦਿਆ ਕਰੂੰਗੀ ਨੰਬਰ ਤਾਂ ਮੇਰੇ ਕੋਲ ਹੈਗਾ ਹੀ ਆ ਤੁਹਾਡਾ ਹਾਂ ਹਾਂ ਕੋਈ ਗੱਲ ਨਹੀਂ ਲੈ ਆਇਆ ਕਰਾਂਗੇ ਹੁਣ ਤਾਂ ਨਹੀਂ ਤੁਹਾਨੂੰ ਲੋੜ ਕੋਈ ਚੀਜ਼ ਦੀ ਵੀ ਅੱਜ ਆਉਣਾ ਹੀ ਹੈ ਕੋਈ ਗੱਲ ਨਹੀਂ ਦੇਖ ਲਿਓ ਵੀ ਜਿਵੇਂ ਤੁਹਾਨੂੰ ਇੱਥੋਂ ਦੀ ਕਿਵੇਂ ਲੱਗਦੀ ਹੈ ਜੇ ਤੁਹਾਨੂੰ ਲੱਗਿਆ ਵੀ ਇਹ ਤੁਹਾਨੂੰ ਨਹੀਂ ਸਹੀ ਲੱਗਦਾ ਜਾਂ ਰੇਟ ਦਾ ਕੋਈ ਲੱਗਦਾ ਤਾਂ ਫਿਰ ਮੰਡੀ 'ਚ ਦੇਖ ਲਿਆ ਕਰਾਂਗੇ ਦੋ ਜਣੀਆਂ ਦਾ ਸਾਥ ਹੋ ਜੂਗਾ ਚੱਲ ਵਧੀਆ ਇੱਦਾਂ ਤਾਂ ਹਾਂ ਹਾਂ ਹਾਂ ਨਹੀਂ ਕੋਈ ਗੱਲ ਨਹੀਂ ਕੋਈ ਚੀਜ਼ ਲੈਣੀ ਹੈਗੀ ਤਾਂ ਜਿਵੇਂ ਟਾਈਮ ਕੱਢ ਕੇ ਪਰ ਇੰਨਾ ਨਾ ਪਹਿਲਾਂ ਦੱਸਣਾ ਪਊ ਬੱਚੇ ਛੋਟੇ ਆ ਦੇਖੋ ਸਰਦੀ ਦਾ ਮੌਸਮ ਆ ਹੈ ਨਾ ਅਤੇ ਫਿਰ ਕੋਈ ਨਹੀਂ ਕਿਸੇ ਦਿਨ ਦੇਖ ਲਵਾਂਗੇ ਟਾਈਮ ਕੱਢ ਲਵਾਂਗੇ ਕੋਈ ਇੱਥੇ ਜਿਹੜੀ ਚੀਜ਼ ਦੀ ਲੋੜ ਹੈ ਆਪਾਂ ਲੈ ਆਵਾਂਗੇ ਮਾਰਕੀਟ 'ਚ ਜਾ ਕੇ ਵਧੀਆ ਹੈ ਚੀਜ਼ਾਂ ਤਾਂ ਵਧੀਆ ਮਿਲਦੀਆਂ ਹਾਂ ਹਾਂ ਕੋਈ ਗੱਲ ਨਹੀਂ ਵੀ ਮਾਰਕੀਟ ਦੇ ਵਿੱਚ ਵੀ ਹੈਗਾ ਵੀ ਚਲੋ ਜਦੋਂ ਜਾਵਾਂਗੇ ਉੱਦਾਂ ਤਾਂ ਹੁਣ ਜੇ ਮੈਂ ਨਾਮ ਵੀ ਲਊ ਤੁਹਾਨੂੰ ਤਾਂ ਨਾਮ ਵੀ ਨਹੀਂ ਪਤਾ ਲੱਗਣਾ ਹੈ ਨਾ ਵੀ ਜਿਵੇਂ ਤੁਸੀਂ ਨਵੇਂ ਹੋ ਜਿਵੇਂ ਆਪਾਂ ਚੱਲਾਂਗੇ ਉਦੋਂ ਕੀ ਨਾਮ ਹੈਗਾ ਤੁਹਾਨੂੰ ਦੱਸ ਦੂੰਗੀ ਨਾਲ ਕਈ ਵਾਰ ਬੰਦੇ ਨੂੰ ਇਕੱਲੇ ਨੂੰ ਵੀ ਜਾਣਾ ਪੈਂਦਾ ਜਾਂ ਜੇ ਲੋੜ ਐਮਰਜੈਂਸੀ ਬੰਦਾ ਵੀ ਆਪਣਾ ਕੰਮ ਆਪ ਵੀ ਕਰ ਸਕਦਾ ਫਿਰ ਤਾਂ ਹਾਂ ਬਾਕੀ ਕੋਈ ਟੈਂਸ਼ਨ ਵਾਲੀ ਗੱਲ ਨਹੀਂ ਵੈਸੇ ਕੀ ਨਾਮ ਹੈਗਾ ਇੰਨਾ ਜ਼ਿਆਦਾ ਲੰਬਾ ਚੌੜਾ ਵੀ ਨੀਗਾ ਵੀ ਜਲਦੀ ਸਮਝ ਆ ਜਾਊਗਾ ਤੁਹਾਨੂੰ ਧਿਆਨ ਆ ਜਾਊਗਾ ਹਾਂ ਹਾਂ ਹਾਂ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਚਾਹ ਪਾਣੀ ਨੂੰ ਇੱਧਰ ਵੀ ਤੁਹਾਡੇ ਹੀ ਆ ਉੱਧਰ ਵੀ ਇੱਕੋ ਹੀ ਗੱਲ ਹੀ ਹੈ ਹਾਂ ਹਾਂ ਆਊਗਾ ਚਲੋ ਹਾਂ ਠੀਕ ਹੈ ਦੀਦੀ ਫਿਰ ਹਾਂ ਠੀਕ